ਹਾਂਜੀ ਬੋਲੋ ਵਧੀਆ ਸਰ ਵਧੀਆ ਕੌਣ ਜੀ ਹਾਂਜੀ ਨਵਾ ਸ਼ਹਿਰ ਤੋਂ ਬੋਲ ਰਿਹਾ ਜੀ ਹਾਂਜੀ

ਹਾਂਜੀ ਹਾਂਜੀ ਹਾ ਹਾਂਜੀ ਸਰ ਕੋਈ ਦਿੱਕਤ ਨੀ ਹੈ ਦੇਖੋ ਬਟ ਸਰ ਇੱਥੇ ਤਾਂ ਬਹੁਤ ਜ਼ਿਆਦਾਤਰ ਨਾ ਜਿੱਦਾਂ ਹੁਣ ਆਪਾਂ ਲਾ ਲੈਂਦੇ ਆ ਜਿੱਦਾਂ ਬੱਸ ਸਟੈਂਡ ਦੇ ਲਾਗੇ ਸ਼ਾਗੇ ਲਾ ਲੈਂਦੇਬੱਸ ਸਟੈਂਡ ਦੇ ਕੋਲ ਇੱਕ ਤਾਂ ਰਾਮ ਰਾਮ ਪ੍ਰਸ਼ਾਦ ਚਾਟ ਭੰਡਾਰ ਹੈ ਉਹਦਾ ਜੀ ਇੱਕ ਨੰਬਰ ਉਹਦੀਆਂ ਚਾਟ ਦੀਆਂ ਪਲੇਟਾਂ ਹੋ ਗਈਆਂ ਅਤੇ ਇੱਕ ਉਹਦੀ ਪਾਪੜੀ ਚਾਟ ਵੀ ਹੋ ਗਈ ਕੋਈ ਵੀ ਆਪਾਂ ਸਮਾਨ ਉਹਦੇ ਕੋਈ ਵੀ ਫਾਸਟਫੂਡ ਖਾਂਦੇ ਹਾਂ ਸਿਰਫ਼ ਇੱਕ ਨੰਬਰ ਟੇਸਟੀ ਅਤੇ ਸਵਾਦ ਹੁੰਦਾ ਹੈ ਜੀ ਅਤੇ ਆਪਾਂ ਦੂਜੀ ਗੱਲ ਉਹਦੇ 'ਚ ਲਾ ਲੈਂਦੇ ਹਾਂ ਜੀ ਜਿੱਦਾਂ ਹੁਣ ਉੱਥੇ ਜਦੋਂ ਬੰਗਿਆਂ ਰੋਡ ਦੇ ਵਿੱਚ ਇੱਕ ਖੜ੍ਹਦਾ ਜੀ ਉਹਦਾ ਨਾਂ ਹੈਗਾ ਸ਼੍ਰੀ ਰਾਮ ਚਾਟ ਫੂਡ ਵਾਲੇ ਹੁਣ ਉਹਨਾਂ ਉਹਨਾਂ ਦਾ ਵੀ ਮਤਲਬ ਵਧੀਆ ਵਧੀਆ ਚਾਟ ਮਤਲਬ ਬਹੁਤ ਫੇਮਸ ਫੇਮਸ ਜਗ੍ਹਾ ਹੈ ਇੱਦਾਂ ਦੀ ਕੋਈ ਦਿੱਕਤ ਹੀ ਨੀ ਹੈਗੀ ਹੈ ਤੁਸੀਂ ਮਤਲਬ ਜੇ ਫਾਸਟਫੂਡ ਦਾ ਜ਼ਿਆਦਾਤਰ ਗੱਲ ਕਰ ਰਹੇ ਹੋ ਤਾਂ ਨਵਾ ਸ਼ਹਿਰ ਬੱਸ ਸਟੈਂਡ ਦੇ ਵਿੱਚ ਤੁਹਾਨੂੰ ਕੋਈ ਚੱਕਰ ਨੀ ਹੈਗਾ ਮੈਂ ਗੱ ਗੱਲ ਕਰ ਲੈਂਦਾ ਵੀਡਿਓ ਤੁਹਾਡੀ ਬਣਵਾਂਦੇਗੀ ਕੋਈ ਦਿੱਕਤ ਨੀ ਹੈਗੀ ਹੈ ਵੀਡਿਓ ਪਰ ਤੁਸੀਂ ਕਿੰਨੇ ਮਿੰਟ ਦੀ ਲੈ ਕੇ ਜਾਣੀ ਹੈ ਜੀ ਅੱਛਾ ਨੋਰਮਲ ਫੂਡ ਵਲੌਗ ਤੁਸੀਂ ਕੋਈ ਦਿੱਕਤ ਨੀ ਹੈ ਕੋਈ ਦਿੱਕਤ ਨੀ ਸਰ ਆ ਕੇ ਮੈਨੂੰ ਫ਼ੋਨ ਲਾ ਲਿਓ ਕੋਈ ਦਿੱਕਤ ਨੀ ਹੈਗੀ ਨਹੀਂ ਨਹੀਂ ਕੋਈ ਦਿੱਕਤ ਨੀ ਸਰ ਮੈਨੂੰ ਕੌ ਮੈਂ ਕੋਲ ਕਰ ਦਿੰਦਾ ਤੁਹਾਨੂੰ ਠੀਕ ਹੈ ਜੀ ਓਕੇ ਸਰ ਥੈਂਕ ਯੂ ਜੀ ਓਕੇ ਜੀ